ਮੇਰਾ ਨਾਮ ਜਗਮੋਹਣ ਸਿੰਘ ਹੈ ਮੈਂ ਮੇਰਾ ਪਿੰਡ ਭਲਿਆਣ ਹੈ ਜੋ ਜ਼ਿਲ੍ਹਾ ਰੋਪੜ ਵਿੱਚ ਪੈਂਦਾ ਹੈ ਮੈਂ ਪਲੱਸ ਟੂ ਤੱਕ ਪੜ੍ਹਿਆ ਹਾਂ ਅਗਰ ਮੈਂ ਆਪਣੀ ਫੈਮਲੀ ਬਾਰੇ ਦੱਸਾਂ ਤਾਂ ਮੇਰੀ ਫੈਮਿਲੀ ਵਿੱਚ ਮੇਰੀ ਮਾਤਾ ਮੇਰੀ ਘਰਵਾਲੀ ਆ ਦੋ ਬੱਚੇ ਆ ਜੀ ਜਿਹਨਾਂ ਦਾ ਨਾਮ ਕਰਮਜੀਤ ਕੌਰ ਕੋਮਲਪ੍ਰੀਤ ਕੌਰ ਬੇਟੇ ਦਾ ਨਾਮ ਯੁਵਰਾਜ ਸਿੰਘ ਹੈ ਜੋ ਮੇਰੀ ਹੋ ਘਰਵਾਲੀ ਹਾਉਸਵਾਈਫ਼ ਹੈ ਮੇਰੀ ਬੇਟੀ ਜੋ ਕੋਮਲਪ੍ਰੀਤ ਕੌਰ ਪਲੱਸ ਟੂ 'ਚ ਪੜ੍ਹਦੀ ਹੈ ਮੇਰੀ ਬੇਟਾ ਯੁਵਰਾਜ ਸਿੰਘ ਟੇਂਨਥ ਕਲਾਸ ਵਿੱਚ ਪੜ੍ਹਦਾ ਹੈ ਅਤੇ ਮੈਨੂੰ ਘੁੰਮਣ ਫ਼ਿਰਨ ਦਾ ਬਹੁਤ ਸ਼ੌਕ ਹੈ ਅਤੇ ਮੇਰਾ ਟੀਚਾ ਹੈ ਕਿ ਮੈਂ ਕੈਨੇਡਾ ਜਾਣਾ ਚਾਹੁੰਦਾ ਹਾਂ